ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਭ ਤੋਂ ਨਾ ਪਟਿਆਲੇ ਦਾ ਜਿਹੜਾ ਫੇਮਸ ਗੁਰਦੁਆਰਾ ਸਾਹਿਬ ਹੈ ਨਾ ਉਹ ਦੂਖਨਿਵਾਰਣ ਸਾਹਿਬ ਹੈ ਹਾਂਜੀ ਤੁਸੀਂ ਉੱਥੇ ਆ ਸਕਦੇ ਹੋ ਕਿਉਂਕਿ ਉੱਥੇ ਨਾ ਗੁਰੂ ਤੇਗ ਬਹਾਦਰ ਜੀ ਨੇ ਆਏ ਸੀਗੇ ਗੁਰੂ ਤੇਗ ਬਹਾਦਰ ਜੀ ਚਰਨ ਛੋਹ ਪ੍ਰਾਪਤ ਹੈ ਗੁਰੂ ਤੇਗ ਬਹਾਦਰ ਜੀ ਦੀ ਹਾਂਜੀ ਅਤੇ ਕਾਫੀ ਨਾ ਪਟਿਆਲੇ ਵਿੱਚ ਜਿਹੜੇ ਕਾਫੀ ਗੁਰਦੁਆਰਾ ਸਾਹਿਬ ਨੇ ਇਹਨਾਂ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਹੀ ਨੇ ਇਹਦੇ ਵਿੱਚ ਕਰਹਾਲੀ ਸਾਹਿਬ ਵੀ ਆ ਜਾਂਦਾ ਅਤੇ ਹੋਰ ਇੱਕ ਬਹਾਦਰਗੜ੍ਹ ਸਾਹਿਬ ਵੀ ਹੈ ਉਹ ਨਾ ਯੂਨੀਵਰਸਿਟੀ ਦੇ ਨੇੜੇ ਹੀ ਹੈ ਤੁਸੀਂ ਉੱਥੇ ਵੀ ਜਾ ਸਕਦੇ ਹਾਂਜੀ ਹਾਂਜੀ ਉਹਦੇ ਨਾ ਰੋਡ 'ਤੇ ਹੀ ਹੈ ਉਹ ਬਹਾਦਰਗੜ ਕੋਲ ਗੁਰਦੁਆਰਾ ਸਾਹਿਬ ਹਾਂਜੀ ਹਾਂਜੀ ਹਾਂਜੀ ਹਾਂਜੀ ਹਿਸਟੋਰੀਕਲੀ ਆ ਉਹ ਗੁਰੂ ਤੇਗ ਬਹਾਦਰ ਜੀ ਚਰਨ ਛੋਹ ਪ੍ਰਾਪਤ ਹੈ ਉਹ ਗੁਰਦੁਆਰਾ ਸਾਹਿਬ ਵੀ ਲੋਕ ਉੱਥੇ ਨਾ ਵਿਸਾਖੀ ਵਾਲੇ ਦਿਨ ਆਉਂਦੇ ਨੇਗੇ ਅਤੇ ਉੱਥੇ ਵੀ ਲੋਕ ਅੰਮ੍ਰਿਤ ਵੀ ਛੱਕ ਕੇ ਜਾਂਦੇ ਨੇਗੇ ਕਾਫੀ ਮਹਾਨਤਾ ਉਹ ਗੁਰਦੁਆਰਾ ਸਾਹਿਬ ਦੀ ਹਾਂਜੀ ਹਾਂਜੀ ਅਤੇ ਇੱਕ ਇੱਥੇ ਨਾ ਮੋਤੀ ਬਾਗ ਸਾਹਿਬ ਗੁਰਦੁਆਰਾ ਵੀ ਹੈ ਹਾਂਜੀ ਹਾਂਜੀ ਹਾਂਜੀ ਕੋਈ ਨਹੀਂ ਹਾਂਜੀ ਹਾਂਜੀ ਕੋਈ ਨਹੀਂ ਕੋਈ ਨਹੀਂ ਥੈਂਕ ਯੂ